ਹੈਲੋ ਹੈਲੋ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਸਰ ਦਿੱਤੇ ਸੀਗੇ ਜੀ ਹਾਂਜੀ ਹਾਂਜੀ ਸਰ ਬੀ ਟੈਕ ਕੰਪਿਊਟਰ ਸਾਇੰਸ ਸਰ ਓਕੇ ਸਰ ਹਾਂਜੀ ਹਾਂਜੀ ਸਰ ਓਕੇ ਸਰ ਓਕੇ ਸਰ ਹਾਂਜੀ ਹਾਂਜੀ ਸਰ ਹੈਗੀ ਇੱਥੇ ਤੁਸੀਂ ਵੈਕੈਂਸੀ ਮੈਨੂੰ ਦੱਸ ਸਕਦੇ ਹੋ ਕਿਹੜੀ ਹੈਗੀ ਹੈ ਵੀ ਅੱਛਾ ਜੀ ਓਕੇ ਜੀ

ਅਤੇ ਸਰ ਅਸੀਂ ਕਦੋਂ ਤੋਂ ਮਤਲਵ ਸਟਾਰਟ ਵਗੈਰਾ ਕਦੋਂ ਤੋਂ ਕਰ ਸਕਦੇ ਅਸੀਂ

ਹਾਂਜੀ ਸਰ ਕਿਸੇ ਦੋ ਲਈ ਨਹੀਂ ਕਰ ਸਕਦੇ ਅੱਛਾ ਜੀ ਓਕੇ ਸਰ ਇੱਕ ਲਈ ਅਪਲਾਈ ਕਰ ਸਕਦੇ ਹੋ ਠੀਕ ਹੈ ਸਰ ਅਤੇ ਸਰ ਇਹ ਮਤਲਬ ਪ੍ਰੋਸੈਸ ਮਤਲਬ ਕਿੱਦਾਂ ਇੰਟਰਵਿਊ ਤੋਂ ਬਾਅਦ ਅੱਗੇ ਵਧੇਗਾ ਮਤਲਬ ਵੀ ਸਲੈਕਸ਼ਨ ਓਕੇ ਜੀ ਠੀਕ ਹੈ ਜੀ ਓਕੇ ਸਰ ਹਾਂਜੀ ਸਰ ਹਾਂਜੀ ਸਰ ਓਕੇ ਸਰ ਅਤੇ ਸਰ ਇਹਦੀ ਕੋਈ ਮਤਲਬ ਤੁਸੀਂ ਮੈਨੂੰ ਸੈਲਰੀ ਵਗੈਰਾ ਦੱਸ ਸਕਦੇ ਹੋ ਨਹੀਂ ਮਤਲਬ ਓਕੇ ਸਰ ਠੀਕ ਹੈ ਜੀ ਠੀਕ ਹੈ ਜੀ ਟ੍ਰੇਨਿੰਗ ਤੋਂ ਬਾਅਦ ਸਰ ਠੀਕ ਹੈ ਸਰ ਤੁਸੀਂ ਮੈਨੂੰ ਗੂਗਲ ਫੋਮ ਹੈ ਜਿਹੜਾ ਉਹ ਸੈਂਡ ਕਰ ਦਓ ਅਤੇ ਉਹ ਮੈਂ ਭਰ ਹਾਂਜੀ ਹਾਂਜੀ ਸਰ ਇਸ ਨੰਬਰ 'ਤੇ ਤੁਸੀਂ ਮੈਨੂੰ ਗੂਗਲ ਫਾਰਮ ਕਰ ਦਿਓ ਸੈਂਡ ਹੈ ਨਾ ਮੈਂ ਉਹ ਫਿਲ ਕਰਦੂੰ ਅਤੇ ਉਸ ਤੋਂ ਬਾਅਦ ਮੈਂ ਆ ਜਾਵਾਂ ਤੁਹਾਡੇ ਕੋਲ ਰੀਜ਼ਨ ਟੈਸਟ ਵਗੈਰਾ ਲਈ ਅੱਗੇ ਦੇ ਪ੍ਰੋਸੀਜਰ ਲਈ ਹਾਂਜੀ ਹਾਂਜੀ ਹਾਂਜੀ ਸਰ ਤੁਸੀਂ ਸਰ ਓਕੇ ਸਰ ਓਕੇ ਸਰ ਠੀਕ ਹੈ ਜੀ ਤੁਸੀਂ ਮੈਨੂੰ ਨਾ ਗੂਗਲ ਫੋਮ ਸੈਂਡ ਕਰ ਦਿਓ ਜੀ ਓਕੇ ਸਰ ਥੈਂਕ ਯੂ ਸਰ